ਮੈਂ ਇਹ ਫੈਸਲਾ ਲਿਆ ਕਿ ਮੈਂ ਦੀਵਾਲੀ 'ਤੇ ਚਿੱਤਰ ਬਣਾਵਾਂਗੀ ਫਿਰ ਮੈਂ ਆਪਣੇ ਪਾਪਾ ਨਾਲ ਬਾਜ਼ਾਰ ਗਈ ਅਤੇ ਮੈਂ ਸਾਰਾ ਸਮਾਨ ਲਿਆ ਕਿ ਮੈਂ ਕਿਸ ਤਰ੍ਹਾਂ ਚਿੱਤਰ ਬਣਾਉਣਾ ਹੈ ਮੈਂ ਸਾਰੇ ਰੰਗ ਲਏ ਚਾਟ ਲਿਆ ਫਿਰ ਮੈਂ ਘਰ ਆ ਕੇ ਸਭ ਕੁਝ ਦੇਖਿਆ ਘਰੇ ਕਿਸ ਤਰ੍ਹਾਂ ਦੀਵਾਲੀ ਮਨਾ ਮਨਾਉਂਦੇ ਹਾਂ ਫਿਰ ਮੈਂ ਚਾਟ ਉਪਰ ਬਣਾਇਆ ਕਿ ਪਹਿਲਾਂ ਗਣੇਸ਼ ਜੀ ਅਤੇ ਲਕਸ਼ਮੀ ਜੀ ਨੂੰ ਬਣਾਇਆ ਅਤੇ ਫਿਰ ਮੈਂ ਜਿਵੇਂ ਕਿ ਮ ਮੰਮੀ ਘਰ ਸਫਾਈ ਕਰਦੀ ਹੈ ਉਵੇਂ ਮੈਂ ਸਫਾਈ ਅਤੇ ਚਿੱਤਰ ਬਣਾਇਆ ਅਤੇ ਬਹੁਤ ਜਿਵੇਂ ਕਿ ਅਸੀਂ ਦੀਵਾਲੀ ਉੱਪਰ ਪਟਾਕੇ ਚਲਾਉਂਦੇ ਹਾਂ ਅਤੇ ਦੀਵਾਲੀ ਦੀ ਸਫਾਈ ਕਰਦੇ ਹਾਂ ਅਤੇ ਲਾਈਟਾਂ ਲਗਾਉਂਦੇ ਹਾਂ ਅਤੇ ਪੂਜਾ ਕਰਦੇ ਹਾਂ ਦੀਵਾਲੀ 'ਤੇ ਅਤੇ ਇਸ ਤਰ੍ਹਾਂ ਮੈ ਦੇਖ ਕੇ ਸਭ ਕੁਛ ਉਸਦੇ ਉਸਦੇ ਉੱਪਰ ਚਿੱਤਰ ਬਣਾਇਆ ਅਤੇ ਦੀਵਾਲੀ 'ਤੇ ਪਟਾਕੇ ਬਣਾਏ ਅਤੇ ਰੰਗੋਲੀ ਬਣਾਈ ਜਿਵੇਂ ਕਿ ਅਸੀਂ ਘਰ ਵਿੱਚ ਬਣਾਉਂਦੇ ਹਾਂ ਅਤੇ ਕੀ ਪੂਜਾ ਕਰਦੇ ਹਾਂ ਅਤੇ ਦੀਵਾਲੀ ਉੱਪਰ ਮੈਂ ਚਿੱਤਰ ਬਹੁਤ ਹੀ ਸੋਹਣਾ ਬਣਾਇਆ ਅਤੇ ਉਸ ਨੂੰ ਚਾਟ 'ਤੇ ਦਿਖਾਇਆ ਅਤੇ ਉਸ ਦੀ ਰੰਗ ਰੰਗ ਕੀਤੇ ਉਸਦੇ ਉੱਪਰ ਅਤੇ